ਮੈਂ ਹਰਮਨਜੀਤ ਕੌਰ ਮੈਂ ਪ੍ਰੀਤ ਢਾਬੇ ਤੋਂ ਕੁ ਮੈਂ ਪ੍ਰੀਤ ਢਾਬੇ ਤੋਂ ਖਾਣ ਵਾਲੀਆਂ ਵਸਤਾਂ ਔਡਰ ਕੀਤੀਆਂ ਸੀ ਮੇਰੇ ਘਰ ਵਿੱਚ ਕੁਝ ਮਹਿਮਾਨ ਅਚਾਨਕ ਹੀ ਆ ਗਏ ਪਰ ਮੇਰੇ ਕੋਲ ਖਾਣਾ ਬਣਾਉਣ ਦਾ ਟਾਈਮ ਨਹੀਂ ਸੀ ਜਦੋਂ ਕਿ ਇੱਕ ਵੱਜ ਗਿਆ ਸੀ ਮੈਂ ਤੁਹਾਡੇ ਢਾਬੇ ਤੋਂ ਮੈਂ ਤੁਹਾਡੇ ਢਾਬੇ ਤੋਂ ਪਨੀਰ ਟਿੱਕਾ ਕੜੀ ਚਾਵਲ ਅਤੇ ਅਠਾਰਾਂ ਰੋਟੀਆਂ ਔਡਰ ਕੀਤੀਆਂ ਸਨ ਜਿਸ ਕਰਕੇ ਮੇਰੇ ਕੁਝ ਮਹਿਮਾਨ ਮੇਰੇ ਥੋੜ੍ਹੇ ਜਿਹੇ ਮਹਿਮਾਨ ਬੀਮਾਰ ਸਨ ਜਿਸ ਕਰਕੇ ਮੈਂ ਅਠਾਰਾਂ ਰੋਟੀਆਂ ਦੀ ਜਗ੍ਹਾ 'ਤੇ ਸਿਰਫ ਦਸ ਰੋਟੀਆਂ ਮੰਗਵਾਉਣਾ ਚਾਹੁੰਦੀ ਹਾਂ ਅਤੇ ਦੋ ਪਲੇਟਾਂ ਕੜੀ ਦੀ ਜਗ੍ਹਾ 'ਤੇ ਸਿਰਫ ਇੱਕ ਪਲੇਟ ਹੀ ਕੜੀ ਦੀ ਮੰਗਵਾਉਣਾ ਚਾਹੁੰਦੀ ਹਾਂ ਮੈਂ ਕਿਰਪਾ ਕਰਕੇ ਤੁਸੀਂ ਮੇਰਾ ਔਡਰ ਜਲਦੀ ਤੋਂ ਜਲਦੀ ਭੇਜਣ ਦੀ ਕਿਰਪਾਲਤਾ ਕਰੋ ਅਤ ਮੈਂ ਤੁਹਾਡਾ ਬਹੁਤ ਹੀ ਧੰਨਵਾਦੀ ਹੋਵਾਂਗੀ